ਹਾਂਜੀ ਅੱਜ ਦੇ ਟਾਈਮ 'ਤੇ ਬਿਲਕੁਲ ਸਹੀ ਹੈ ਕਿ ਜਿਹੜਾ ਕੀ ਹੈ ਰਾਜਨੀਤਿਕ ਤਣਾਅ ਪੈਦਾ ਹੁੰਦਾ ਕਿ ਉਹ ਧਾਰਮਿਕ ਸੰਸਥਾਵਾਂ ਨੂੰ ਯੂਜ ਕਰਦੇ ਨੇ ਪਰ ਮੇਰਾ ਇਹ ਮੰਨਣਾ ਕਿ ਜਦੋਂ ਵੀ ਆਪਾਂ ਵੋਟਸ ਪਾਉਂਦੇ ਹਾਂ ਜਾਂ ਰਾਜਨੀਤਿਕ ਦੇ ਵਿੱਚ ਧਰਮ ਨੂੰ ਨਹੀਂ ਲੈ ਕੇ ਆਉਣਾ ਚਾਹੀਦਾ ਕਿਉਂਕਿ ਧਰਮ ਜਿਹੜਾ ਉਹ ਅਲੱਗ ਹੈ ਰਾਜਨੀਤਿਕ ਅਲੱਗ ਹੈ ਪਰ ਰਾਜਨੀਤੀ ਕੀ ਹੈ ਇੱਕ ਉਹਨਾਂ ਦੇ ਇਮੋਸ਼ਨਸ 'ਤੇ ਕੰਮ ਕਰਦੀ ਹੈ ਮਤਲਬ ਧਾਰਮਿਕ ਸੰਸਥਾਵਾਂ ਨੂੰ ਇਹ ਦੱਸਿਆ ਜਾਂਦਾ ਕਿ ਜਿੰਨੇ ਤੁਹਾਡੇ ਨਾਲ ਜੁੜੇ ਹੋਏ ਹੈ ਕਿ ਤੁਸੀਂ ਇਸ ਪਾਰਟੀ ਨੂੰ ਵੋਟ ਪਵਾਓ ਹੁਣ ਕੀ ਹੈ ਆਪਣੀ ਅੱਗੇ ਐਮ ਪੀਆਂ ਦੀ ਵੋਟਸ ਆ ਰਹੀਆਂ ਨੇ ਪਰ ਮੈਂ ਤਾਂ ਇਹੀ ਮਤਲਬ ਉਹਨਾਂ ਨੂੰ ਹੀ ਵੋਟ ਪਾਊਂਗੀ ਜਿਹੜੇ ਕਿ ਜਿਹੜੀ ਪਾਰਟੀ ਕੀ ਹੈ ਇੱਕ ਐਜੁਕੇਸ਼ਨ ਪੋਲਿਸੀ 'ਤੇ ਕੰਮ ਕਰੇਗੀ ਮਤਲਬ ਮੈਨੂੰ ਧਰਮ ਨੂੰ ਲੈ ਕੇ ਰਲੀਜਨ ਨੂੰ ਲੈ ਕੇ ਜਾਂ ਫਿਰ ਕਿਸੇ ਹੋਰ ਚੀਜ਼ਾਂ ਨੂੰ ਲੈ ਕੇ ਬੈਨੀਫਿਟਸ ਹੋ ਰਹੇ ਹੈ ਉਹਨਾਂ ਨੂੰ ਦੇਖ ਕੇ ਵੋਟ ਬਿਲਕੁਲ ਨਹੀਂ ਪਾਊਂਗੀ ਤਾਂ ਮੈਂ ਆਪਣੇ ਯੂਥ ਨੂੰ ਇਹੀ ਦੱਸਣਾ ਚਾਹੁੰਦੀ ਹਾਂ ਕਿ ਉਹ ਇਨ੍ਹਾਂ ਸਭ ਚੀਜ਼ਾਂ ਨੂੰ ਨਾ ਦੇਖਣ ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਬਾਈਕਾਟ ਹੋਣਾ ਚਾਹੀਦਾ ਜੋ ਕਿ ਧਰਮ ਨੂੰ ਲੈ ਕੇ ਵੰਡ ਪਵਾਉਂਦੇ ਹੈ